ਮੇਰਾ ਇੱਕ ਦੋਸਤ ਹੈ ਜਿਸ ਦਾ ਨਾਮ ਜਸਵੀਰ ਹੈ ਉਹ ਚਿੱਤਰਕਾਰੀ ਕਰਦਾ ਹੈ ਉਸ ਨੇ ਇੱਕ ਚਿੱਤਰ ਬਣਾਇਆ ਹੋਇਆ ਸੀਗਾ ਜਿਸ ਵਿੱਚ ਆਈ ਆਈ ਟੀ ਦਾ ਗੇਟ ਗੇਟ 'ਤੇ ਹਿਰਨ ਬਣੇ ਹੋਏ ਸੀ ਔਰ ਉਸ ਤੋਂ ਅੱਗੇ ਪਾਰਕ ਦੋਨੋਂ ਸਾਈਡ ਪਾਰਕ ਹੈ ਉਸ ਤੋਂ ਅੱਗੇ ਐਡਮਿਨ ਔਰ ਉਸ ਤੋਂ ਇਲਾਵਾ ਲਾਇਬ੍ਰੇਰੀ ਬੁਆਏ ਹੋਸਟਲ ਔਰ ਗਰਲ ਹੋਸਟਲ ਅਤੇ ਫੈਕਿਲਟੀ ਓਫਿਸ ਹੋਸਟਲ ਬਣੇ ਹੋਏ ਹਨ ਔਰ ਉਹ ਕਾਫੀ ਵਧੀਆ ਲੱਗੀ ਇਸ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਡਰਾਇੰਗ ਕਰਨ ਦਾ ਮਨ ਬਣਾ ਲਿਆ